ਸਾਡੇ ਪਿੰਡ ਵਿੱਚ ਇੱਕ ਖਾਸ ਥਾਂ ਹੈ ਜਿਹਦਾ ਜਿਹੜਾ ਕਿ ਮੰਦਰ ਬਣਿਆ ਹੋਇਆ ਹੈ ਜਿੱਥੇ ਕਿ ਹਨੂੰਮਾਨ ਜੀ ਦੀ ਬਹੁਤ ਵੱਡੀ ਮੂਰਤੀ ਬਣੀ ਹੋਈ ਹੈ ਜਦੋਂ ਵੀ ਮੈਨੂੰ ਛੁੱਟੀ ਹੁੰਦੀ ਹੈ ਜਾਂ ਛੁੱਟੀਆਂ ਪੈਂਦੀਆਂ ਹੈ ਸਾਡੇ ਘਰ ਗੈਸਟ ਵੀ ਆਉਂਦੇ ਹੈ ਤਾਂ ਉਹਨਾਂ ਨਾਲ ਆਪਾਂ ਉੱਥੇ ਹਰ ਰੋਜ਼ ਜਾਂਦੇ ਹਾਂ ਮਤਲਬ ਉੱਥੇ ਕਾਫੀ ਸਾਰੀਆਂ ਹੋਰ ਵੀ ਚੀਜ਼ਾਂ ਬਣੀਆਂ ਹੋਈਆਂ ਹੈ ਸਵਿਵਿੰਗ ਪੂਲ ਬਣਿਆ ਆ ਉੱਥੇ ਬੱਚੇ ਜਿਹੜੇ ਆ ਉਹ ਖੇਲ ਸਕਦੇ ਐ ਮੇਰੀ ਦੀਦੀ ਦੇ ਬੱਚੇ ਆ ਉਹ ਹਮੇਸ਼ਾ ਉੱਥੇ ਜਾ ਕੇ ਬਹੁਤ ਮਸਤੀ ਕਰਦੇ ਆ ਉੱਥੇ ਕਈ ਜਦੋਂ ਗਰਮੀ ਦੀ ਛੁੱਟੀਆਂ ਹੁੰਦੀਆਂ ਤਾਂ ਉੱਥੇ ਬਹੁਤ ਹੀ ਵੱਡਾ ਲੰਗਰ ਕਰਵਾਇਆ ਜਾਂਦਾ ਹੈ ਅਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਆ ਅਲੱਗ ਅਲੱਗ ਜਗ੍ਹਾ ਤੋਂ ਲੋਕ ਆਉਂਦੇ ਆ ਅਤੇ ਉੱਥੇ ਉਥ ਉੱਥੋਂ ਦਾ ਜਿਹੜਾ ਦ੍ਰਿਸ਼ ਉਹ ਦੇਖਣ ਵਾਲਾ ਉੱਥੇ ਮਤਲਬ ਆਪਣੇ ਆਪ ਜਿਹੜਾ ਵਣ ਆ ਉਹ ਆਪਣੇ ਆਪ ਆਇਆ ਸੀ ਮਤਲਬ ਰਾਤ ਸਵੇਰ ਦੇ ਟਾਈਮ ਜਦੋਂ ਕੋਈ ਉੱਠਿਆ ਤਾਂ ਉਹਨਾਂ ਨੇ ਦੇਖਿਆ ਅਤੇ ਉਹ ਜਿਹੜੇ ਦਰਖਤ ਹੈ ਉਹ ਉੱਡਦੇ ਉੱਡਦੇ ਆਏ ਕਰਦੇ ਸੀ ਅਤੇ ਉੱਥੇ ਉੱਥੇ ਜਿਹੜੇ ਉਹ ਸਟੇ ਕਰ ਗਏ ਮਤਲਬ ਮੈਨੂੰ ਜਦੋਂ ਵੀ ਛੁੱਟੀ ਹੁੰਦੀ ਆ ਮੈਂ ਉੱਥੇ ਹੀ ਜਾਣਾ ਪਸੰਦ ਕਰਦੀ ਆ ਆਪਣੇ ਪਰਿਵਾਰ ਨਾਲ ਉੱਥੇ ਜਾ ਕੇ ਬਹੁਤ ਹੀ ਵਧੀਆ ਮਹਿਸੂਸ ਹੁੰਦਾ